ਮੈਂ ਅਮਨਦੀਪ ਕੌਰ ਮੈਂ ਜਦ ਪ੍ਰਾਈਮਰੀ ਸਕੂਲ ਵਿੱਚ ਪੜ੍ਹਦੀ ਸੀ ਤੀਸਰੀ ਕਲਾਸ ਦੀ ਵਿਦਿਆਰਥਣ ਸੀ ਤਾਂ ਮੈਨੂੰ ਖੋ ਖੋ ਦਾ ਬਹੁਤ ਸ਼ੌਂਕ ਸੀ ਖੋ ਖੋ ਖੇਡਦੇ ਖੇਡਦੇ ਹੀ ਮੈਂ ਪੰਜਵੀਂ ਕਲਾਸ ਵਿੱਚ ਜਦੋਂ ਹੋਈ ਤਾਂ ਮੈਂ ਬਲਾਕ ਲੈਵਲ 'ਤੇ ਖੇਡਿਆ ਉਹਦੇ ਵਿੱਚ ਮੈਨੂੰ ਵਧੀਆ ਨੰਬ ਸਕੋਰ ਮਿਲੇ ਇੱਕ ਸਰਟੀਫਿਕੇਟ ਦਿੱਤਾ ਇੱਕ ਮਾਡ ਮੈਡਲ ਦਿੱਤਾ ਉਸ ਤੋਂ ਬਾਅਦ ਜਦ ਅਸੀਂ ਪ੍ਰਾਇਮਰੀ ਜਦ ਅਸੀਂ ਹਾਈ ਸਕੂਲ ਵਿੱਚ ਗਏ ਤਾਂ ਉਥੇ ਵੀ ਮੈਂ ਇਹ ਆਪਣੀ ਗੇਮ ਨਾਲ ਰੱਖੀ ਉਹਦੇ ਨਾਲ ਹੀ ਮੈਂ ਹਾਕੀ ਦੀ ਗੇਮ ਜੋਇਨ ਕਰਲੀ ਅਤੇ ਮੇਰੀ ਮੰਮੀ ਪਾਪਾ ਨੂੰ ਮੈਂ ਪੁੱਛਿਆ ਅਤੇ ਉਹ ਕਹਿੰਦੇ ਕੋਈ ਨਹੀਂ ਜੋ ਤੁਸੀਂ ਚਾਹੁੰਦੇ ਹੋ ਕਰ ਸਕਦੇ ਹੋ ਉਹਦੇ ਵਿੱਚ ਵੀ ਮੈਂ ਜ਼ਿਲ੍ਹਾ ਲੈਵਲ ਜ਼ਿਲ੍ਹਾ ਲੈਵਲ 'ਤੇ ਖੇਡੀ ਜ਼ਿਲ੍ਹਾ ਲੈਵਲ 'ਤੇ ਖੇਡਣ ਨਾਲ ਵੀ ਮੈਨੂੰ ਮੈਡਲ ਮਿਲਿਆ ਨਾਲ ਸਰਟੀਫਿਕੇਟ ਮਿਲਿਆ ਕਾਫੀ ਚੀਜ਼ਾਂ ਦੀ ਖੇਡਾਂ ਤੋਂ ਮੈਨੂੰ ਸ਼ੁਰੂ ਤੋਂ ਹੀ ਰੁਚੀ ਸੀ ਰੁਚੀ ਖੇਡਾਂ ਦੇ ਨਾਲ ਨਾਲ ਮੈਂ ਪੜ੍ਹਾਈ 'ਚ ਵੀ ਬਹੁਤ ਵਧੀਆ ਹੁਸ਼ਿਆਰ ਸੀ ਇਸ ਲਈ ਮੈਂ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਸੀ ਉਸ ਤੋਂ ਬਾਅਦ ਜਦ ਅਸੀਂ ਹਾਈ ਜਦ ਅਸੀਂ ਸੀਨੀ ਸੀਨੀਅਰ ਸੈਕੰਡਰੀ ਸਕੂਲ 'ਚ ਪਲੱਸ ਟੂ ਵਿੱਚ ਸੀ ਤਾਂ ਮੇਰੇ ਵਧੀਆ ਨੰਬਰ ਆਏ ਉਹਦੇ ਨਾਲ ਨਾਲ ਮੈਂ ਗੇਮ ਨੂੰ ਵੀ ਆਪਣੇ ਨਾਲ ਰੈਗੂਲਰ ਰੱਖਿਆ ਕਾਫੀ ਪ੍ਰੈਕਟਿਸ ਵੀ ਕਰਦੇ ਰਹੇ ਕਾਫੀ ਚੀਜ਼ਾਂ ਦੇ ਨਾਲ ਨਾਲ ਰੁਚੀ ਵੀ ਵਧੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਅਸੀਂ ਅਸੀਂ ਜ਼ਿਲ੍ਹਾ ਲੈਵਲ 'ਤੇ ਖੇਡਿਆ ਜ਼ਿਲ੍ਹਾ ਲੈਵਲ 'ਤੇ ਖੇਡਣ ਨਾਲ ਵੀ ਸਾਨੂੰ ਮੈਡਲ ਮਿਲਿਆ ਸੈਕਿੰਡ ਪੋਜੀਸ਼ਨ ਆਈ ਉਸਦੇ ਵਿੱਚ ਵੀ ਅਸੀਂ ਬਹੁਤ ਵਧੀਆ ਪੇਸ਼ਕਸ਼ ਪੇਸ਼ ਕੀਤੀ ਉਹਦੇ ਨਾਲ ਨਾਲ ਮੈਨੂੰ ਖੇਡਾਂ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀ ਬਹੁਤ ਰੁਚੀ ਸੀ ਮੈਂ ਅੱਜ ਵੀ ਆਪਣੀ ਖੇਡਾਂ ਨੂੰ ਆਪਣੇ ਨਾਲ ਆਪਣੇ ਰੁਚੀ ਦਿੰਨੀ ਹਾਂ ਆਪਣੇ ਲਈ ਆਪਣੇ ਤੱਕ ਹੀ ਰੱਖਦੀ ਹਾਂ ਬਹੁਤ ਖੇਡਾਂ ਮੈਨੂੰ ਅੱਜ ਵੀ ਬਹੁਤ ਮਨਪਸੰਦ ਹਨ